ਹੈਲੋ ਸਤਿ ਸ਼੍ਰੀ ਅਕਾਲ ਰਮਨ ਬਸ ਵਧੀਆ ਪਹਿਚਾਨਿਆ ਹਾਂਜੀ ਹਾਂਜੀ ਸਭ ਵਧੀਆ ਮੈਂ ਤਾਂ ਤੁਹਾਨੂੰ ਇੱਕ ਖਬਰ ਦੱਸਣੀ ਸੀ ਤੁਹਾਨੂੰ ਪਤਾ ਸਾਡੇ ਗੁਆਂਢੀਆਂ ਦਾ ਮੁੰਡਾ ਉਹ ਵੀ ਬਾਹਰ ਚਲ ਗਿਆ ਕੋਸ਼ਿਸ਼ ਹੈਗੀ ਓਹੀ ਨਾ ਮੈਂ ਤਾਂ ਓਹੀ ਕਹਿਣਾ ਹੀ ਸਾਰੇ ਬਾਹਰ ਜਾਈ ਜਾਂਦੇ ਇੱਥੇ ਰਹਿ ਕੇ ਕੁਛ ਬਣਨ ਕੁਛ ਕਰਨ ਤਾਂ ਤਾਂ ਵੀ ਵਧੀਆ ਬਾਹਰ ਜਾ ਕੇ ਕੀ ਕਰ ਲੈਣਾ ਇਹਨਾਂ ਲੋਕਾਂ ਨੇ ਹੋਰ ਬਸ ਵਧੀਆ ਤੁਸੀਂ ਸੁਣਾਓ ਤੁਸੀਂ ਬਾਹਰ ਨਾ ਭੇਜਿਓ ਤੁਸੀਂ ਵੀ ਆਪਣੇ ਮੁੰਡੇ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਤੁਹਾਨੂੰ ਹੋਰ ਸੁਣਾਓ ਕੀ ਕਰਦਾ ਵੈਸੇ ਤੁਹਾਡਾ ਮੁੰਡਾ ਅੱਜ ਕੱਲ੍ਹ ਮੈਂ ਤਾਂ ਕਹਿੰਦੀ ਹਾਂ ਉਹਨੂੰ ਕੋਲ ਉਹਨੂੰ ਕਹੋ ਕਿ ਸਰਕਾਰੀ ਨੌਕਰੀ ਭਰੇ ਇੱਥੇ ਰਹਿ ਕੇ ਸਗੋਂ ਕੁਛ ਬਣੇ ਉੱਥੇ ਜਾ ਕੇ ਕੀ ਉਹਨੇ ਕਰ ਲੈਣਾ ਵਾ ਬਾਹਰ ਜਾ ਕੇ ਐਵੇਂ ਉਹੀ ਮਜ਼ਦੂਰੀਆਂ ਹੀ ਕਰਨੀਆਂ ਉਹਨਾਂ ਨੇ ਹੋਰ ਕੀ ਕਰਨਾ ਹੈਗਾ ਵਾ ਚਲੋ ਕੋਈ ਨਹੀਂ ਤੁਹਾਡੇ ਮੁੰਡੇ ਨੂੰ ਨਾ ਮੈਂ ਮਿਲ ਕੇ ਸਮਝਾਉਂਗੀ ਠੀਕ ਆ ਚਲੋ ਠੀਕ ਆ ਓਕੇ